ਹਾਂਜੀ ਪਾਣੀ ਸਾਡੇ ਲਈ ਬਹੁਤ ਜ਼ਰੂਰੀ ਹੈ ਪਾਣੀ ਤੋਂ ਬਿਨਾ ਅਸੀਂ ਕੁਛ ਨਹੀਂ ਕਰ ਸਕਦੇ ਜਦੋਂ ਅਸੀਂ ਸਾਡੀ ਸਵੇਰ ਹੁੰਦੀ ਹੈ ਤਾਂ ਪਾਣੀ ਦੇ ਨਾਲ ਹੀ ਹੁੰਦੀ ਹੈ ਇਹ ਮੇਰਾ ਕਹਿਣਾ ਹੈ ਜਿਵੇਂ ਸਭ ਤੋਂ ਪਹਿਲਾਂ ਪਾਣੀ ਪੀਣ ਲਈ ਬਹੁਤ ਜ਼ਰੂਰੀ ਹੈ ਪਾਣੀ ਨਹਾਉਣ ਲਈ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਕੁਝ ਵੀ ਬਣਾਉਂਦੇ ਹਾਂ ਉਹਦੇ ਲਈ ਪਾਣੀ ਬਹੁਤ ਜ਼ਰੂਰੀ ਆ ਕੋਈ ਵੀ ਸਬਜ਼ੀ ਬਣਦੀ ਹੈ ਤਾਂ ਪਾਣੀ ਦਾ ਹੋਣਾ ਬਹੁਤ ਜ਼ਰੂਰੀ ਆ ਅਸੀਂ ਕੁਛ ਵੀ ਸਾਫ ਕਰਦੇ ਹਾਂ ਜਿਵੇਂ ਸਾਡੇ ਕੱਪੜੇ ਦੀ ਮੰਨ ਲਓ ਗੰਦੇ ਹੁੰਦੇ ਆ ਤਾਂ ਉਹਦੇ ਲਈ ਵੀ ਪਾਣੀ ਬਹੁਤ ਜ਼ਰੂਰੀ ਹੈ ਅਸੀਂ ਬਰੱਸ਼ ਕਰਦੇ ਹਾਂ ਸਵੇਰੇ ਉੱਠ ਕੇ ਦੰਦ ਸਾਫ ਕਰਦੇ ਹਾਂ ਤਾਂ ਉਹਦੇ ਲਈ ਵੀ ਪਾਣੀ ਬਹੁਤ ਜ਼ਰੂਰੀ ਹੈ ਸਵੇਰੇ ਅਸੀਂ ਜਦੋਂ ਨਹਾਉਂਦੇ ਹਾਂ ਆਪਣੇ ਕੱਪੜੇ ਉਤਾਰਦੇ ਹਾਂ ਤਾਂ ਉਹਨਾਂ ਨੂੰ ਵੀ ਅਸੀਂ ਜਦੋਂ ਧੋਣਾ ਹੁੰਦਾ ਤਾਂ ਉਹਦੇ ਲਈ ਵੀ ਪਾਣੀ ਬਹੁਤ ਜ਼ਰੂਰੀ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈ ਜਿਹ ਜਿਹਦੇ ਨਾਲ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਿਆਦਾ ਜਿਵੇਂ ਕੋਈ ਇਲੈਕਟਰੋਨਿਕ ਚੀਜ਼ ਆ ਉਹਨੂੰ ਸਾਫ ਕਰਨ ਵਿੱਚ ਵੀ ਪਾਣੀ ਬਹੁਤ ਜ਼ਰੂਰੀ ਹੈ ਪਾਣੀ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਸਾਡੇ ਘਰ ਕੋਈ ਬਗੀਚਾ ਹੈ ਕੋਈ ਫੁੱਲਾਂ ਦਾ ਪੌਦਾ ਹੈ ਅਤੇ ਉਹਨੂੰ ਵੀ ਪਾਣੀ ਦੇਣਾ ਬਹੁਤ ਜ਼ਰੂਰੀ ਹੈ ਪਾਣੀ ਹੋਵੇਗਾ ਤਾਂ ਹੀ ਅਸੀਂ ਆਪਣੇ ਜ਼ਿੰਦਗੀ ਵਿੱਚ ਅੱਗੇ ਅੱਗੇ ਵੱਧ ਸਕਦੇ ਹਾਂ ਪਾਣੀ ਦੀ ਬਹੁਤ ਮਹੱਤਤਾ ਹੈ ਸਾਡੇ ਜੀਵਨ ਵਿੱਚ ਰੋਜ਼ ਲਈ ਪਾਣੀ ਬਹੁਤ ਜ਼ਰੂਰੀ ਹੈ ਧੰਨਵਾਦ